ਪੇਂਡੂ ਖੇਡਾਂ ਖੇਡਣ ਨਾਲ ਲੋਕਾਂ ਵਿੱਚ ਆਪਸ ਵਿੱਚ ਗੱਲਬਾਤ ਹੁੰਦੀ ਹੈ ਉਹ ਇੱਕ ਦੂਜੇ ਨਾਲ ਸਹਿਯੋਗ ਦਿੰਦੇ ਹਨ ਜਿਸ ਨਾਲ ਉਹਨਾਂ ਵਿੱਚ ਸਪੋਰਟਸ ਮੈਂਬਰਸ਼ਿਪ ਦੀ ਭਾਵਨਾ ਜਾਗਦੀ ਹੈ ਆਪਸੀ ਸਹਿਮਤੀ ਨਾਲ ਉਹ ਖੇਡਾਂ ਖੇਡਦੇ ਹਨ ਜਿਸ ਕਰਕੇ ਉਹਨਾਂ ਦੀ ਏਕਤਾ ਵਿੱਚ ਵੀ ਵਿਕਾਸ ਹੁੰਦਾ ਹੈ ਜੇਕਰ ਕੋਈ ਵੀ ਵਿਅਕਤੀ ਸਲਾਨਾ ਖੇਡਾਂ ਕਰਵਾਉਂਦਾ ਹੈ ਤਾਂ ਉਸ ਦੀ ਚਰਚਾ ਆਸ ਪਾਸ ਦੇ ਕਈ ਪਿੰਡਾਂ ਵਿੱਚ ਹੁੰਦੀ ਹੈ ਜਿਸ ਨਾਲ ਇੱਕ ਪਿੰਡ ਦਾ ਵਿਕਾਸ ਅਤੇ ਪ੍ਰਸ਼ੰਸ਼ਾ ਦੋਵੇਂ ਹੁੰਦੀਆਂ ਹਨ ਇਸ ਤੋਂ ਸਿਵਾ ਇੱਥੇ ਹੋਰ ਵੀ ਬਹੁਤ ਸਾਰੇ ਸੋਰਸਿਸ ਹਨ ਜਿਸ ਵਿੱਚ ਬਹੁਤ ਲਾਭ ਪ੍ਰਾਪਤ ਹੁੰਦੇ ਹਨ ਪਿੰਡਾਂ ਦੇ ਨੌਜਵਾਨ ਇੱਕ ਖੇਡਾਂ ਕਰਕੇ ਨਸ਼ੇ ਸੰਬੰਧੀ ਕਾਰਕਾ ਤੋਂ ਬਚੇ ਰਹਿੰਦੇ ਹਨ ਦੂਰ ਰਹਿੰਦੇ ਹਨ ਜਿਸ ਨਾਲ ਉਹਨਾਂ ਦਾ ਫਿਊਚਰ ਨਸ਼ਿਆਂ ਆਦਿ ਤੋਂ ਬਚਿਆ ਰਹਿੰਦਾ ਹੈ ਅਤੇ ਉਹਨਾਂ ਦੀ ਲਾਈਫ ਖਰਾਬ ਨਹੀਂ ਹੁੰਦੀ ਅਤੇ ਅੱਗੇ ਲਾਈਫ ਵਿੱਚ ਵੀ ਉਹਨਾਂ ਨੂੰ ਖੇਡਾਂ ਦੇ ਸੰਬੰਧ ਕਈ ਪ੍ਰਕਾਰ ਦੇ ਪਲੇਟਫਾਮ ਮਿਲਦੇ ਹਨ ਜਿਹਨਾਂ ਕਾਰਨਾਂ ਅੱਗੇ ਵੀ ਉਹ ਨੈਸ਼ਨਲ ਤੱਕ ਜਾ ਸਕਦੇ ਹਨ ਜਿਹਨਾਂ ਨਾਲ ਉਹਨਾਂ ਦੀ ਲਾਈਫ ਸਟਾਰਟ ਹੋ ਜਾਂਦੀ ਹੈ ਅਤੇ ਉਹ ਵਧੀਆ ਖੇਡਣ ਨਾਲ ਉਹਨਾਂ ਨੂੰ ਅੱਗੇ ਬਹੁਤ ਵਧੀਆ ਖੇਡਾਂ